ਮਸ਼ਹੂਰ ਹਸਤੀਆਂ ਗੋਪਨੀਯਤਾ ਦੀ ਘਾਟ ਦੇ ਕਈ ਕਾਰਣ ਹੋ ਸਕਦੇ ਹਨ ਜਿਵੇਂ ਕਿ ਪਹਿਲਾਂ ਕਿ ਸਾਨੂੰ ਅਸੀਂ ਵੇਖਦੇ ਹਾਂ ਪਬਲਿਕ ਦੇ ਦਿਲਚਸਪੀ ਦੇ ਵਿੱਚ ਮਸ਼ਹੂਰ ਹਸਤੀਆਂ ਦੀ ਜ਼ਿਦਗੀ ਵਿੱਚ ਲੋਕਾਂ ਦੀ ਵੱਡੀ ਦਿਲਚਸਪੀ ਹੁੰਦੀ ਹੈ ਮੀਡੀਆ ਅਤੇ ਪ੍ਰਸ਼ੰਸ਼ਕ ਉਹਨਾਂ ਦੀ ਜ਼ਿਦਗੀ ਦੇ ਹਰ ਪਲ ਬਾਰੇ ਜਾਣਨਾ ਚਾਹੁੰਦੇ ਹਨ ਮੀਡੀਆ ਦਾ ਦਬਾਅ ਮੀਡੀਆ ਨੂੰ ਆਪਣੀ ਖ਼ਬਰਾਂ ਵੇਚਣ ਲਈ ਮਸ਼ਹੂਰ ਹਸਤੀਆਂ ਦੀ ਜਿੰਦਗੀ ਬਾਰੇ ਖੁਲਾਸਿਆਂ ਦੀ ਲੋੜ ਹੁੰਦੀ ਹੈ ਅਖ਼ਬਾਰਾਂ ਮੈਗਜ਼ੀਨਾਂ ਅਤੇ ਔਨਲਾਈਨ ਪਲੈਟਫੋਰਮਾ 'ਤੇ ਅਸੀਂ ਉਹਨਾਂ ਬਾਰੇ ਖ਼ਬਰਾਂ ਦੀ ਵੱਡੀ ਮੰਗ ਕਰਦੇ ਹਾਂ ਸਮਾਜਿਕ ਮੀਡੀਆ ਅੱਜ ਕੱਲ੍ਹ ਮਸ਼ਹੂਰ ਹਸਤੀਆਂ ਆਪਣੇ ਉਨ ਪ੍ਰਸ਼ੰਸ਼ਕਾਂ ਨਾਲ ਜੁੜਨ ਲਈ ਸਮਾਜਿਕ ਮੀਡੀਆ ਦੀ ਵਰਤੋਂ ਕਰਦੀਆਂ ਹਨ ਜਿਵੇਂ ਕਿ ਇਸ ਨਾਲ ਉਹਨਾਂ ਦੀ ਜ਼ਿਦਗੀ ਦੇ ਬਹੁਤ ਸਾਰੇ ਪਹਿਲੂ ਜਨਤਕ ਹੁੰਦੇ ਹਨ ਪ੍ਰਸਿੱਧੀ ਅਤੇ ਕਾਰੋਬਾਰ ਵੀ ਇਹਨਾਂ ਦੇ ਵਿੱਚ ਹੀ ਆ ਜਾਂਦਾ ਹੈ ਕਈ ਵਾਰ ਮਸ਼ਹੂਰ ਹਸਤੀਆਂ ਆਪਣੇ ਆਪ ਨੂੰ ਚਰਚਾ ਵਿੱਚ ਰੱਖਣ ਦੇ ਲਈ ਜ਼ਿਦਗੀ ਦੇ ਵੱਖ ਵੱਖ ਪਹਿਲੂਆਂ ਨੂੰ ਜਨਤਕ ਕਰਦੀਆਂ ਹਨ ਇਸ ਨਾਲ ਉਹਨਾਂ ਦੀ ਪ੍ਰਸਿੱਧੀ ਵੱਧਦੀ ਹੈ ਜਿਵੇਂ ਕਿ ਉਹਨਾਂ ਦੇ ਕਾਰੋਬਾਰ ਦੇ ਵਿੱਚ ਵੀ ਫ਼ਾਇਦਾ ਹੁੰਦਾ ਹੈ ਅਤੇ ਉਹਨਾਂ ਨੂੰ ਇਸ ਦੇ ਨਾਲ ਇਨਕਮ ਦੇ ਰਿਸੋਰਸਿਜ਼ ਵੀ ਉਹਨਾਂ ਦੇ ਬਹੁਤ ਵੱਧਦੇ ਹਨ ਪ੍ਰਾਈਵੇਸੀ ਦਾ ਘਟਨਾ ਪ੍ਰਾਈਵੇਸੀ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਘੱਟ ਜਾਂਦੀ ਹੈ ਮਸ਼ਹੂਰ ਹੋਣ ਦਾ ਮਤਲਬ ਹੈ ਕਿ ਬਹੁਤ ਸਾਰੇ ਲੋਕ ਉਹਨਾਂ ਨੂੰ ਪਛਾਣਦੇ ਹਨ ਜੋ ਕਿ ਉਹਨਾਂ ਲਈ ਨਿੱਜੀ ਜਗ੍ਹਾ ਅਤੇ ਸਮੇਂ ਦੀ ਘਾਟ ਪੈਦਾ ਕਰ ਸਕਦਾ ਹੈ ਇਹ ਸਾਰੇ ਕਾਰਣ ਮਿਲ ਕੇ ਮਸ਼ਹੂਰ ਹਸਤੀਆਂ ਦੀ ਗੋਪਨੀਯਤਾ ਨੂੰ ਪ੍ਰਭਾਵਿਤ ਕਰਦੇ ਹਨ